ਕਈ ਤਰ੍ਹਾਂ ਦੇ ਖਾਸ ਸੱਭਿਆਚਾਰਕ ਅਭਿਆਸ ਹੁੰਦੇ ਨੇ ਜੋ ਪੂਜਾ ਦੌਰਾਨ ਅਪਣਾਏ ਜਾਂਦੇ ਹਨ ਪਰ ਸਿੱਖ ਧਰਮ ਵਿੱਚ ਅਸੀਂ ਸਿੱਖ ਧਰਮ ਤੋਂ ਨਾਲ ਸੰਬੰਧ ਰੱਖਦੇ ਹਾਂ ਸਿੱਖ ਧਰਮ ਵਿੱਚ ਇੱਕ ਗੱਤਕਾ ਹੈ ਇੱਕ ਸੱਭਿਆਚਾਰਕ ਅਭਿਆਸ ਹੈ ਜੋ ਅਸੀਂ ਜਨਮ ਦਿਹਾੜੇ ਹੋਣ ਜਦੋਂ ਗੁਰੂ ਸਾਹਿਬਾਨ ਦੇ ਸ਼ਹੀਦੀ ਦਿਹਾੜੇ ਹੋਣ ਨਗਰ ਕੀਰਤਨ ਪਿੰਡਾਂ ਵਿੱਚ ਨਿਕਲਦੇ ਹਨ ਅਤੇ ਉਸ ਸਮੇਂ 'ਤੇ ਅਸੀਂ ਉਹ ਵਾਲਾ ਸੱਭਿਆਚਾਰਕ ਗੱਤਕਾ ਜੋ ਹੈ ਉਹਨੂੰ ਅਪਣਾਉਂਦੇ ਹਾਂ ਇੱਕ ਪੂਜਾ ਦੇ ਦੌਰਾਨ ਅਤੇ ਪਹਿਲਾਂ ਜਿਸ ਨਾਲ ਪੂਰਾ ਜਿਸ ਵੀ ਵਿਅਕਤੀ ਨੇ ਉਹ ਪ੍ਰਾਣੀ ਨੇ ਕਰਨਾ ਹੁੰਦਾ ਵਾ ਗੱਤਕਾ ਖੇਡਣਾ ਹੁੰਦਾ ਵਾ ਉਹ ਪੂਰਾ ਬਾਣਾ ਪਾਉਂਦਾ ਹੈ ਦਸਤਾਰ ਸਜਾਉਂਦਾ ਹੈ ਸ਼ਸਤਰ ਧਾਰਨ ਕਰਦਾ ਹੈ ਸਾਰੇ ਉਸ ਤੋਂ ਬਾਅਦ ਇੱਕ ਸਿੰਘ ਬਣ ਕੇ ਸਿੰਘ ਵਾਂਗੂ ਉਹ ਬਾ ਜਿਸ ਤਰ੍ਹਾਂ ਸਿੰਘਾਂ ਸ਼ਹੀਦਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਸੀ ਉਸੇ ਦੌਰਾਨ ਫਿਰ ਉਹ ਆਪਣੇ ਜੌਹਰ ਵਿਖਾਉਂਦਾ ਹੈ ਜੋ ਕਿ ਅਸੀਂ ਆਪਣੀ ਇੱਕ ਪੂਜਾ ਵੱਲੋਂ ਉਹਨਾਂ ਨੂੰ ਵਰਤਿਆ ਜਾਂਦਾ ਹੈ ਗੱਤਕਾ ਜਿਹੜਾ ਹੈ ਗੱਤਕਾ ਸਾਡਾ ਸੱਭਿਆਚਾਰਕ ਅਭਿਆਸ ਹੈ ਜੋ ਅਸੀਂ ਇੱਕ ਪੂਜਾ ਦੌਰਾਨ ਅਪਣਾਉਂਦੇ ਹਾਂ